ਮੈਂ ਆਪਣੇ ਆਰਟਵਰਕ ਵਿੱਚ ਕੁਦਰਤ ਨਾਲ਼ ਜੁੜੇ ਹੋਏ ਦ੍ਰਿਸ਼ ਬਣਾਉਂਦਾ ਹਾਂ ਕਿਉਂਕਿ ਕੁਦਰਤ ਇਸ ਵਿੱਚ ਮੇਰੀ ਬਹੁਤ ਵਧੀਆ ਮਦਦ ਕਰਦੀ ਹੈ ਕੁਦਰਤ ਹਰ ਮਿੰਟ ਬਾਅਦ ਆਪਣਾ ਨਵਾਂ ਰੂਪ ਲੈਂਦੀ ਹੈ ਜਦੋਂ ਮੈਂ ਬਾਹਰ ਪਹਾੜੀ ਇਲਾਕਿਆਂ ਵਿੱਚ ਜਾ ਕੇ ਉੱਥੇ ਵਧੀਆ ਦ੍ਰਿਸ਼ ਅੱਖਾਂ ਵਿੱਚ ਕੈਦ ਕਰਕੇ ਅੱਖਾਂ ਵਿੱਚ ਕੈਦ ਕਰਕੇ ਵਧੀਆ ਦ੍ਰਿਸ਼ ਬਣਾਉਂਦਾ ਹਾਂ ਮੈਂ ਉੱਥੋਂ ਦੇ ਫੁੱਲਾਂ ਨੂੰ ਆਪਣੀ ਅੱਖਾਂ ਵਿੱਚ ਕੈਦ ਕਰਕੇ ਬਹੁਤ ਸਾਰੀਆਂ ਵਧੀਆ ਪੇਂਟਿੰਗਸ ਬਣਾਉਂਦਾ ਹਾਂ ਮੈਨੂੰ ਕੁਦਰਤ ਨਾਲ਼ ਬਹੁਤ ਪਿਆਰ ਹੈ ਮੈਂ ਉੱਥੇ ਜਾ ਕੇ ਕੁਦਰਤ ਦੀ ਹਰ ਇੱਕ ਚੀਜ਼ ਨੂੰ ਆਪਣੀਆਂ ਅੱਖਾਂ ਵਿੱਚ ਕੈਦ ਕਰਕੇ ਫਿਰ ਵਧੀਆ ਵਧੀਆ ਦ੍ਰਿਸ਼ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਮੈਨੂੰ ਪਹਾੜੀ ਇਲਾਕਿਆਂ ਵਿੱਚ ਘੁੰਮਣ ਦਾ ਬਹੁਤ ਸ਼ੌਕ ਹੈ